ਜਿਵੇਂ ਕਿ ਅਸੀਂ ਕਦੇ ਵਿਕਲਪਿਕ ਰਨਿੰਗ ਵਰਕਆਊਟ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਅਸੀਂ ਜਿਵੇਂ ਵੀ ਵੱਡੀਆਂ ਮਸ਼ੀਨਾਂ ਵੱਡੇ ਜਿਮ ਅਸੀਂ ਨਹੀਂ ਜੁਆਇਨ ਕੀਤੇ ਨਾ ਵੱਡੀਆਂ ਮਸ਼ੀਨਾਂ 'ਤੇ ਮਤਲਬ ਅਸੀਂ ਐਕਸਰਸਾਈਜ਼ ਕੀਤੀ ਹੈ ਅਸੀਂ ਜਿਵੇਂ ਕਿ ਪਾਰਕ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਉਹਨਾਂ ਦਾ ਯੂਜ਼ ਕੀਤਾ ਮਤਲਬ ਉਹਨਾਂ 'ਤੇ ਐਕਸਰਸਾਈਜ਼ ਜ਼ਰੂਰ ਕੀਤੀ ਹੈ ਜਿਵੇਂ ਸ਼ਾਮ ਦੇ ਟੈਮ ਅਸੀਂ ਬੱਚਿਆਂ ਨੂੰ ਲੈ ਜਾਣਾ ਪਾਰਕ ਦੇ ਵਿੱਚ ਬੱਚੇ ਪਾਰਕ ਵਿੱਚ ਖੇਡ ਲੈਂਦੇ ਹੈ ਅਤੇ ਅਸੀਂ ਉਹਨਾਂ ਮਸ਼ੀਨਾਂ 'ਤੇ ਪਾਰਕ ਵਿੱਚ ਜਿਹੜੀਆਂ ਲੱਗੀਆਂ ਵੀਆਂ ਮਤਲਬ ਉਹਨਾਂ ਮਸ਼ੀਨਾਂ 'ਤੇ ਐਕਸਰਸਾਈਜ਼ ਜ਼ਰੂਰ ਕੀਤੀ ਹੈ ਉਹਨਾਂ ਦੇ ਨਾਲ ਸਾਨੂੰ ਕਾਫੀ ਫਾਇਦਾ ਹੁੰਦਾ ਮਤਲਬ ਹੋਇਆ ਵੀ ਹੈ ਜਿਵੇਂ ਕਿ ਉਹ ਐਕਸਰਸਾਈਜ਼ ਉਹ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਮੇਰਾ ਬੀ ਪੀ ਵਧਣਾ ਸਾਹ ਚੜ੍ਹਨਾ ਜਿਵੇਂ ਮੋਟਾਪਾ ਉੱਦਾਂ ਦੀਆਂ ਚੀਜ਼ਾਂ ਸੀਗੀਆਂ ਜਿਵੇਂ ਉਹ ਸ਼ੁਰੂ ਕਰਨ ਤੋਂ ਬਾਅਦ ਵਿੱਚ ਵੀ ਮੋਟਾਪਾ ਵੀ ਘਟਣ ਲੱਗ ਗਿਆ ਸਾਹ ਚੜ੍ਹਨਾ ਬੰਦ ਹੋਇਆ ਅੱਗੇ ਤੋਂ ਮਤਲਬ ਐਨਰਜੀ ਫੀਲ ਹੁੰਦੀ ਹੈ ਜਿਵੇਂ ਸੁਬਹੇ ਉੱਠਣਾ ਤਾਂ ਐਨਰਜੀ ਨਾ ਲੱਗਣਾ ਮਤਲਬ ਲੋਅ ਫੀਲ ਹੁੰਦੀ ਸੀਗੀ ਵੀ ਆਲਸ ਜਿਹਾ ਰਹਿਣਾ ਸੁਸਤ ਸੁਸਤਾਪਣ ਜਿਹਾ ਰਹਿਣਾ ਜਿਵੇਂ ਅਤੇ ਸਰੀਰ ਡਾਊਨ ਡਾਊਨ ਜਿਹਾ ਲੱਗਣਾ ਇੱਦਾਂ ਮਤਲਬ ਸੈਰ ਸ਼ੁਰੂ ਕਰਨ ਤੋਂ ਬਾਅਦ ਵਿੱਚ ਇਹ ਚੀਜ਼ਾਂ ਦਾ ਫਾਇਦਾ ਹੋਇਆ ਹੈ ਜਿਵੇਂ ਸ਼ਾਮ ਦੇ ਟੈਮ ਅਸੀਂ ਸੈਰ ਕਰਨੀ ਮਤਲਬ ਹਲਕੀ ਵੀ ਹੌਲੀ ਹੌਲੀ ਤੁਰ ਕੇ ਜਾਂ ਭੱਜ ਕੇ ਜਿਵੇਂ ਹੌਲੀ ਹੌਲੀ ਅਸੀਂ ਇੱਦਾਂ ਸੈਰ ਕਰਦੇ ਹਾਂ ਸ਼ਾਮ ਨੂੰ ਸੁਬਹੇ ਪਾਰਕ ਦੇ ਵਿੱਚ ਜਿਵੇਂ ਥੋੜ੍ਹੀ ਬਹੁਤੀ ਸੈਰ ਕਰ ਲਈ ਨਾਲੇ ਉਹਨਾਂ ਮਸ਼ੀਨਾਂ ਪਾਰਕ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਉਹਨਾਂ ਦੇ ਉੱਥੇ ਮਤਲਬ ਐਕਸਰਸਾਈਜ਼ ਕਰ ਲਈ ਜਾਂ ਇੱਕ ਰੱਸੀ ਕੁੱਦਣਾ ਨਾਲੇ ਬੱਚਿਆਂ ਦਾ ਗੇਮ ਹੋ ਜਾਂਦਾ ਨਾਲੇ ਆਪਦੇ ਮਤਲਬ ਰੱਸੀ ਜ਼ਰੂਰ ਕੁੱਦੀਏ ਉਹਦੇ ਰੱਸੀ ਕੁੱਦਣਾ ਆਸਾਨ ਹੈ ਇਹਦੇ ਨਾਲ ਜਿਵੇਂ ਵਜ਼ਨ ਵੀ ਘੱਟ ਹੁੰਦਾ ਅਤੇ ਵਜ਼ਨ ਘੱਟ ਵੀ ਹੋਇਆ ਰੱਸੀ ਕੁੱਦਣ ਨਾਲ ਬੀ ਪੀ ਵੀ ਸੈੱਟ ਹੋਇਆ ਸਟਰੈਸ ਵੀ ਥੋੜ੍ਹਾ ਬਹੁਤਾ ਘੱਟ ਹੋਇਆ ਇਹਦੇ ਨਾਲ ਸਟਰੈਸ ਜਿਵੇਂ ਆਪਾਂ ਰੱਸੀ ਕੁੱਦੀਏ ਇਹਦੇ ਨਾਲ ਥੋੜ੍ਹਾ ਫਰੈਸ਼ ਫੀਲ ਹੁੰਦਾ